ਹੈਲੋ ਗੁਰਜੀਤ ਪਹੁੰਚ ਗਏ ਤੁਸੀਂ ਘਰ ਅੱਛਾ ਅਤੇ ਤੈਨੂੰ ਪਤਾ ਨਾ ਮੇਰਾ ਅੱਜ ਬਰਡੇ ਹੈ ਹਾਂ ਅਤੇ ਮੈਂ ਅੱਜ ਘਰ ਨਾ ਪਾਰਟੀ ਰੱਖੀ ਹੋਈ ਹੈ ਮੇਰੀਆਂ ਕੁਝ ਫਰੈਂਡਸ ਆਉਣਗੀਆਂ ਅਤੇ ਮੇਰੇ ਆਫਿਸ ਤੋਂ ਵੀ ਕੁਝ ਬੰਦੇ ਆਉਣਗੇ ਮੇਰੇ ਦੋਸਤ ਅਤੇ ਉਹਨਾਂ ਦੀਆਂ ਫੈਮਿਲੀਜ਼ ਆਉਣਗੀਆਂ ਠੀਕ ਹੈ ਅਤੇ ਉਹਨਾਂ ਵਾਸਤੇ ਆਪਾਂ ਕੀ ਬਣਾਈਏ ਫਿਰ ਅੱਛਾ ਪਹਿਲ ਪਹਿਲਾਂ ਤਾਂ ਇਹ ਗੱਲ ਚਲੋ ਖਾਣਾ ਪੀਣਾ ਤਾਂ ਨਾ ਮੈਂ ਅੱਧੇ ਘੰਟੇ ਪੌਣੇ ਘੰਟੇ ਤੱਕ ਆ ਜੂੰਗੀ ਮੈਂ ਹੈਲਪ ਕਰ ਦੂੰਗੀ ਖਾਣੇ ਪੀਣੇ 'ਚ ਅੱਜ ਮੈਂ ਹਾਫ ਡੇ 'ਤੇ ਹਾਂ ਠੀਕ ਹੈ ਅਤੇ ਤੁਸੀਂ ਸਭ ਤੋਂ ਪਹਿਲਾਂ ਇਹ ਕਰੋ ਕਿ ਘਰ ਦੀ ਸਾਰੀ ਸਾਫ਼ ਸਫਾਈ ਕਰਕੇ ਨਾ ਘਰ ਚਮਕਣਾ ਚਾਹੀਦਾ ਅਤੇ ਡੈਕੋਰੇਸ਼ਨਸ ਵਗੈਰਾ ਕੱਢ ਲਈਓ ਠੀਕ ਹੈ ਅਤੇ ਘਰ ਸਾਰੀ ਡੈਕੋਰੇਸ਼ਨ ਵਗੈਰਾ ਕਰ ਲਈਓ ਆ ਉੱਪਰ ਵਾਲੇ ਰੂਮ 'ਚ ਹੀ ਪਿਆ ਹੋਊਗਾ ਅਤੇ ਉਹ ਕੱਢ ਲੀਓ ਉਹ ਇੱਕ ਨਾ ਲਿਫਾਫੇ 'ਚ ਬੰਨਿਆ ਹੋਊਗਾ ਤਿੰਨ ਲਿਫਾਫੇ ਆ ਡੈਕੋਰੇਸ਼ਨ ਵਾਲੇ ਇਹ ਉਹ ਕੱਢ ਕੇ ਨਾ ਤੁਸੀਂ ਸਾਰੀ ਡੈਕੋਰੇਸ਼ਨਸ ਵਗੈਰਾ ਕਰ ਲਈਓ ਠੀਕ ਹੈ ਹਾਂ ਲ ਅਤੇ ਇੱਧਰ ਵੀ ਕਰਨੀ ਹੈ ਰੂਮ 'ਚ ਵੀ ਆਹ ਜਿਹੜਾ ਆਪਣਾ ਡਰਾਇੰਗ ਰੂਮ ਹੈ ਨਾ ਫਿਰ ਪਹਿਲਾਂ ਤਾਂ ਇੱਥੇ ਹੀ ਆਉਣਗੇ ਨਾ ਸਾਰੇ ਮੇਰੇ ਸਾਰੇ ਫਰੈਂਡ ਓਫਿਸ ਵਾਲੇ ਆਹ ਦੋ ਤਿੰਨ ਗਲੀ ਵਾਲੀਆਂ ਵੀ ਆਉਣਗੀਆਂ ਅਤੇ ਉਹਨਾਂ ਦੇ ਬੱਚੇ ਵੀ ਆਉਣਗੇ ਅਤੇ ਹੁਣ ਐਂ ਦੱਸੋ ਵੀ ਖਾਣਾ ਪੀਣਾ ਕੀ ਬਣਾਉਣਾ ਅੱਛਾ ਅੱਛਾ ਹੋਰ ਹਾਂ ਹਾਂ ਚਨੇ ਤਾਂ ਭਿਓਂਤੇ ਸੀ ਮੈਂ ਰਾਤ ਹੀ ਭਾ ਭਿਓਂਤੇ ਸੀਗੇ ਅਤੇ ਉਹ ਆਪਾਂ ਬਣਾ ਲਿਆਂਗੇ ਉਹ ਤਾਂ ਆ ਕੇ ਪਰ ਨਾ ਜਿਹੜੀ ਮਤਲਬ ਮਾੜਾ ਮੋਟਾ ਜਿਹਾ ਨਾ ਇੱਕ ਵਾਰੀ ਤਿਆਰ ਹੋਣਾ ਚਾਹੀਦਾ ਅਤੇ ਜਿਵੇਂ ਸਾਢੇ ਕੁ ਸੱਤ ਵਜੇ ਮੈਂ ਸਾਰਿਆਂ ਨੂੰ ਕਿਹਾ ਹੋਇਆ ਵੀ ਕਾਰਡਸ ਦਿੱਤੇ ਹੋਏ ਆ ਸਾਰਿਆਂ ਨੂੰ ਸਾਢੇ ਸੱਤ ਵਜੇ ਆਉਣਗੇ ਉਹ ਠੀਕ ਹੈ ਅਤੇ ਅਤੇ ਇੱਕ ਸ਼ਪੈਸ਼ਲ ਪਤਾ ਕੀ ਹੈ ਮੇਰੀ ਇੱਕ ਫਰੈਂਡ ਆ ਰਹੀ ਹੈ ਆਸਟਰੇਲੀਆ ਤੋਂ ਹਾਂ ਤੇ ਉਹ ਉੱਥੇ ਜੱਜ ਹੈ ਆਸਟਰੇਲੀਆ 'ਚ ਅਤੇ ਉਹਦੇ ਵਾਸਤੇ ਕੁਛ ਸ਼ਪੈਸ਼ਲ ਕਰ ਲਈ ਥੋੜ੍ਹਾ ਜਿਹਾ ਹਾਂ ਉਹਨੂੰ ਨਾ ਜ਼ਿਆਦਾ ਡੋਸਾ ਪਸੰਦ ਹੈ ਪਹਿਲਾਂ ਜਦੋਂ ਮੇਰੇ ਨਾਲ ਪੜ੍ਹਦੀ ਹੁੰਦੀ ਸੀ ਉਹਦੇ ਨਾਲ ਡੋਸਾ ਖਾਂਦੀ ਹੁੰਦੇ ਸੀਗੀ ਵੈਸੇ ਤਾਂ ਮੈਂ ਆਪ ਹੀ ਬਣਾਉਂਗੀ ਡੋਸਾ ਕਿਉਂਕਿ ਉਹਨੂੰ ਮੇਰੇ ਹੱਥ ਦਾ ਪਸੰਦ ਹੈ ਤੂੰ ਐਂ ਕਰੀ ਬਾਕੀ ਮਟੀਰੀਅਲ ਰੈਡੀ ਕਰ ਲਈ ਡੋਸੇ ਨਾਲ ਸਾਂਬਰ ਰੈਡੀ ਕਰ ਲਈ ਇੱਕ ਤਾਂ ਅਤੇ ਨਾਰੀਅਲ ਚਟਨੀ ਰੈਡੀ ਕਰ ਲਈ ਅਤੇ ਹੋਰ ਕੀ ਹੁੰਦਾ

ਹਾਂ ਬੱਚਿਆਂ ਵਾਸਤੇ ਤਾਂ ਸਨੈਕਸ ਵਗੈਰਾ ਬਣਾਉਣੇ ਹੀ ਹੈ ਕੁਛ ਬਾਹਰੋਂ ਵੀ ਲੈ ਕੇ ਆਉਣੇ ਹੈ ਠੀਕ ਹੈ ਚਲ ਠੀਕ ਹੈ ਮੈਂ ਨਾ ਉਹ ਲਿਆਉਂਗੀ ਓਕੇ ਮੈਨੂੰ ਲਿਸਟ ਸੈਂਡ ਕਰ ਦੀ ਮੈਂ ਲੈ ਆਉਂਗੀ ਚਲ ਠੀਕ ਹੈ ਬਾਏ ਓਕੇ ਓਕੇ ਠੀਕ ਹੈ ਓਕੇ ਓਕੇ